ਸਾਡੇ ਦੇਸ਼ ਵਿੱਚ ਪੰਜ ਨਦੀਆਂ ਹਨ ਸਾਡੇ ਦੇਸ਼ ਨੂੰ ਪੰਜਾਬ ਨੂੰ ਪੰਜ ਨਦੀਆਂ ਦਾ ਨਾਮ ਦਿੱਤਾ ਗਿਆ ਹੈ ਜਿਨ੍ਹਾਂ ਤੋਂ ਪੰਜ ਦਾ ਆਬ ਪੰਜਾਬ ਦਾ ਨਾਂ ਨਦੀਆਂ ਦੇ ਨਾਂ ਤੋਂ ਰੱਖਿਆ ਗਿਆ ਹੈ ਪੰਜਾਬ ਵਿੱਚ ਪੰਜ ਨਦੀਆਂ ਸਤਲੁਜ ਬਿਆਸ ਰਾਵੀ ਝਨਾਬ ਜੇਹਲਮ ਹਨ ਭਾ ਪੰਜਾਬ ਤੇ ਪਾਕਿਸਤਾਨ ਦੀ ਵੰਡ ਤੋਂ ਬਾਦ ਤਿੰਨ ਨਦੀਆਂ ਪੰਜਾਬ ਵਿੱਚ ਦੋ ਨਦੀਆਂ ਪਾਕਿਸਤਾਨ ਵਿੱਚ ਚਲੀਆਂ ਗਈਆਂ ਪੰਜਾਬ ਵਿੱਚ ਸਤਲੁਜ ਬਿਆਸ ਰਾਵੀ ਨਦੀਆਂ ਰਹਿ ਗਈਆਂ ਝਨਾਬ ਜੇਹਲਮ ਨਦੀਆਂ ਪਾਕਿਸਤਾਨ ਵਿੱਚ ਚਲੀਆਂ ਗਈਆਂ ਸਾਡੇ ਦੇਸ਼ ਵਿੱਚ ਪਾਣੀ ਦੀ ਵਰਤੋਂ ਬਹੁਤ ਲਾਪਰਵਾਹੀ ਨਾਲ ਕੀਤੀ ਜਾ ਰਹੀ ਹੈ ਲੋਕ ਬਹੁਤ ਜਿਆਦਾ ਪਾਣੀ ਦੀ ਵੇਸਟੇਸ ਕਰ ਰਹੇ ਹਨ ਜਿਵੇਂ ਪਾਣੀ ਨੂੰ ਘਰਾਂ ਤੋਂ ਕੋਈ ਹੋਰ ਜਗ੍ਹਾ ਧੋਣ ਲਈ ਪਾਣੀ ਬਹੁਤ ਵੇਸਟ ਹੋ ਰਿਹਾ ਹੈ ਲੋਕ ਪਾਣੀ ਦੀ ਵਿੱਚ ਕੂੜਾ ਕਰਕਟ ਸੁੱਟੀ ਜਾਂਦੇ ਹਨ ਨਹਿਰਾਂ ਵਿੱਚ ਸੂਇਆਂ ਵਿੱਚ ਜਿਸ ਵਿੱਚ ਪਾਣੀ ਬਹੁਤ ਖਰਾਬ ਹੋ ਰਿਹਾ ਹੈ ਇਹ ਸਭ ਸਰਕਾਰ ਨੂੰ ਬੰਦ ਕਰਵਾਉਣਾ ਚਾਹੀਦਾ ਹੈ ਲੋਕਾਂ ਦੀਆਂ ਪਾ ਸੀ ਪਾਣੀ ਦੀਆਂ ਗੰਦੇ ਪਾਣੀ ਵਾਲੀਆਂ ਪਾਇਪਾਂ ਵੀ ਨਹਿਰਾਂ ਵਿੱਚ ਸੂਇਆਂ ਵਿੱਚ ਪਾਈਆਂ ਗਈਆਂ ਹਨ ਜਿਸ ਨਾਲ ਸਾਡਾ ਪਾਣੀ ਦੂਸ਼ਿਤ ਹੁੰਦਾ ਹੈ ਪਾਣੀ ਸਾਡੀ ਜਿੰਦਗੀ ਲਈ ਸਭ ਤੋਂ ਅਹਿਮ ਜਰੂਰਤ ਹੈ ਪਾਣੀ ਤੋਂ ਬਿਨ੍ਹਾਂ ਸਾਡੀ ਜਿੰਦਗੀ ਅਧੂਰੀ ਹੈ ਜਿਸ ਤੋਂ ਬਿਨ੍ਹਾਂ ਅਸੀਂ ਜੀਵਤ ਨਹੀਂ ਰਹਿ ਸਕਦੇ ਸਾਡੇ ਦੇਸ਼ ਦਾ ਪਾਣੀ ਦਿਨ ਬ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ ਕਈ ਜਗ੍ਹਾ ਜਿਵੇਂ ਫਤਿਹਗੜ੍ਹ ਸਾਹਿਬ ਵਿੱਚ ਪਾਣੀ ਬਹੁਤ ਜਿਆਦਾ ਖਤਮ ਹੋ ਚੁੱਕਿਆ ਹੈ ਸਾਡੇ ਆਉਣ ਵਾਲੇ ਬੱਚੇ ਇਸ ਤੋਂ ਬਿਨ੍ਹਾਂ ਕਿਸ ਤਰ੍ਹਾਂ ਜੀਵਤ ਰਹਿਣਗੇ ਇਸ ਬਾਰੇ ਲੋਕਾਂ ਨੂੰ ਸੋਚਣਾ ਚਾਈਦਾ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪਾਣੀ ਦੀ ਵੇਸਟੇਸ ਉੱਪਰ ਪਾਬੰਧੀ ਲਗਾਉਣੀ ਚਾਹੀਦੀ ਹੈ ਜੋ ਲੋਕ ਬਹੁਤ ਜਿਆਦਾ ਪਾਣੀ ਵੇਸਟ ਕਰਦੇ ਹਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਜੁਰਮਾਨਾ ਲਗਾਉਣਾ ਚਾਹੀਦਾ ਹੈ ਤਾਂ ਕੀ ਪਾਣੀ ਦੀ ਵੇਸਟੇਸ ਖਤਮ ਹੋ ਸਕੇ ਸਾਡੇ ਦੇਸ਼ ਵਿੱਚ ਕਈ ਨਦੀਆਂ ਨਦੀਆਂ ਚਲਦੀਆਂ ਹਨ ਜਿਨ੍ਹਾਂ ਵਿੱਚੋਂ ਨੰਗਲ ਡੈਮ ਰਣਜੀਤ ਸਾਗਰ ਡੈਮ ਡੋਲਬਾਹਾ ਡੈਮ ਚਹੋਲ ਡੈਮ ਥਾਣਾ ਡੈਮ ਸ਼ਿਸ਼ਵਾਂ ਡੈਮ ਹਨ